ਹਾਂਜੀ ਮੇਰੇ ਨਾਲ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਮੈਨੂੰ ਮੌਕੇ ਮਿਲੇ ਹਨ ਜਦੋਂ ਮੈਨੂੰ ਵੱਖਰੀ ਭਾਸ਼ਾ ਅਤੇ ਸੱਭਿਆਚਾਰ ਵਾਲੀ ਜਗ੍ਹਾ ਦੇ ਉੱਤੇ ਯਾਤਰਾ ਕਰਨ ਦਾ ਮੌਕਾ ਮਿਲਿਆ ਹੈ ਇੱਕ ਵਾਰ ਦੀ ਗੱਲ ਹੈ ਜਦੋਂ ਮੈਂ ਕੇਰਲਾ ਦੇ ਵਿੱਚ ਗਿਆ ਸੀ ਉੱਥੇ ਮੈਨੂੰ ਸੰਚਾਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਔਖਿਆਈ ਆ ਰਹੀ ਸੀ ਪਰ ਮੈਨੂੰ ਗੁਗਲ ਦੇ ਸ ਰਾਹੀਂ ਬਹੁਤ ਸਾਰਾ ਜਿਹੜਾ ਕਿ ਉੱਥੇ ਕਮਿਊਨੀਕੇਟ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਆਸ ਪਾਸ ਦੇ ਲੋਕਾਂ ਨਾਲ ਸੰਚਾਰ ਕੀਤਾ ਮੈਨੂੰ ਉੱਥੇ ਹੋਟਲ ਅਤੇ ਮੈਨੂੰ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਮਿਲ ਰਹੀ ਸੀ ਇਸ ਕਰਕੇ ਮੈਨੂੰ ਉੱਥੇ ਬਹੁਤ ਜ਼ਿਆਦਾ ਔਖਿਆਈ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਗੁਗਲ ਦੇ ਰਾਹੀਂ ਅਤੇ ਆਸ ਪਾਸ ਦੇ ਇੱਕ ਜੋ ਇੱਕ ਵਿਅਕਤੀ ਮੈਨੂੰ ਮਿਲਿਆ ਜੋ ਕਿ ਇੰਗਲਿਸ਼ ਜਾਣਦਾ ਸੀ ਅਤੇ ਮੈਂ ਉਸ ਏ ਉਸਦੇ ਨਾਲ ਇੰਗਲਿਸ਼ ਦੇ ਵਿੱਚ ਸੰਚਾਰ ਕਰਕੇ ਆਪਣੀ ਉਸ ਭਾਸ਼ਾ ਨੂੰ ਉਹਨਾਂ ਲੋਕਾਂ ਦੁਆਰਾ ਕਹਿਣ ਦਾ ਇੱਕ ਮੁਨਾਸਿਫ ਸਮਾਂ ਬਣਾਇਆ ਅਤੇ ਮੈਂ ਉਨ ਉਸ ਅਨੁਕੂਲ ਬਣਾ ਕੇ ਉਸ ਜਗ੍ਹਾ ਦਾ ਅਨੰਦ ਮਾਣਿਆ ਅਤੇ ਮੈਂ ਉਸ ਵੱਖਰੀ ਸ ਅਤੇ ਸੱਭਿਆਚਾਰ ਵਾਲੀ ਜਗ੍ਹਾ ਦੇ ਉੱਤੇ ਯਾਤਰਾ ਆਪਣੀ ਸਫ਼ਲ ਕੀਤੀ